ਮੈਨੂੰ ਨਹੀਂ ਲੱਗਦਾ ਕਿ ਖਾਣਾ ਬਣਾਉਣਾ ਸਿਰਫ ਔਰਤਾਂ ਦਾ ਹੀ ਕੰਮ ਹੈਗਾ ਬਹੁਤ ਜੇ ਜਿੰਨੇ ਵੀ ਵੱਡੇ ਵੱਡੇ ਸ਼ੈਫ ਹੈਗੇ ਉਹ ਸਾਰੇ ਮਰਦ ਹੈਗੇ ਅਤੇ ਔਰਤਾਂ ਵੀ ਹੈਗੀਆਂ ਪਰ ਮਰਦ ਵੀ ਬਥੇਰੇ ਹੈਗੇ ਅਤੇ ਖਾਣਾ ਬਣਾਉਣਾ ਆਪਣੇ ਆਪਣਾ ਮਨ ਦੀ ਚੀਜ਼ ਹੈਗੀ ਅਤੇ ਇੱਕ ਟੈਲੈਂਟ ਵੀ ਕਹਿ ਸਕਦੇ ਹੈਗਾ ਆਪਣਾ ਆਪਣਾ ਇਹ ਸਾਰਿਆਂ ਨੂੰ ਨਹੀਂ ਆਉਂਦਾ ਬਣਾਉਣਾ ਅਤੇ ਲੋਕ ਸਿੱਖਦੇ ਵੀ ਆ ਸਪੈਸ਼ਲੀ ਆਪਣੇ ਨੂੰ ਸ ਆਪਣੇ ਨੂੰ ਆਪਣੇ ਆਪ ਨੂੰ ਸਿਖਾਉਣ ਵਾਸਤੇ ਵਗੈਰਾ ਵੀ ਕਰ ਇਕੱਲੇ ਰਹਿਣ ਵਾਸਤੇ ਵੀ ਪਰ ਆਹ ਗੱਲ ਨਹੀਂ ਹੈ ਕਿ ਸਿਰਫ ਔਰਤਾਂ ਦਾ ਹੀ ਕੰਮ ਆ ਮਰਦ ਲੋ ਮਰਦਾਂ ਨੂੰ ਵੀ ਸਾਰਿਆਂ ਨੂੰ ਆਉਂਦਾ ਵਾ ਖਾਣਾ ਬ ਮਰਦਾਂ ਨੂੰ ਵੀ ਆਉਣਾ ਚਾਹੀਦਾ ਵਾ ਅਤੇ ਹੈਲਪ ਵਗੈਰਾ ਵੀ ਕਰ ਮਦਦ ਵਗੈਰਾ ਵੀ ਕਰਨੀ ਚਾਹੀਦੀ ਹੈ ਲੋਕ ਔਰਤਾਂ ਵਗੈਰਾ ਦੀ ਜੇ ਉਹ ਖਾਣਾ ਬਣਾਉਂਦੀਆਂ ਪਈਆਂ ਤੁਹਾਡੇ ਵਾਸਤੇ ਅਤੇ ਹਾਂ ਮੈਂ ਵੀ ਕਹਾਂਗਾ ਮੇਰੇ ਪਰਿਵਾਰ ਦੇ ਮਰਦ ਵੀ ਸਾਰੇ ਖਾਣੇ ਬਣਾ ਬਣਾਉਂਦੇ ਆ ਬਲਕਿ ਮੈਂ ਆਪ ਵੀ ਆਪਣੇ ਘਰ ਵਿੱਚ ਖਾਣਾ ਬਣਾਉਂਦਾ ਹਾਂ ਅਤੇ ਕੋਈ ਕਦੀ ਕਦੀ ਮੈਨੂੰ ਇਕੱਲੇ ਵੀ ਰਹਿਣਾ ਪੈਂਦਾ ਮੈਂ ਤਾਂ ਵੀ ਆਪਣੇ ਵਾਸਤੇ ਖਾਣਾ ਬਣਾ ਕੇ ਖਾਂਦਾ ਹਾਂ ਰੋਜ਼